ਵੈਲ ਮੇਰੇ ਕੋਲ ਫੋਰਮਲ ਫੋਟੋਗ੍ਰਾਫੀ ਦਾ ਕੋਈ ਵੀ ਟ੍ਰੇਨਿੰਗ ਨਹੀਂ ਹਾਂ ਇਹ ਮੇਰਾ ਇਨ ਬਿਲਟ ਹੀ ਇੱਕ ਹੋਬੀ ਹੈ ਮੈਨੂੰ ਫੋਟੋਗ੍ਰਾਫੀ ਦੀ ਜਿਹਦੇ ਵਿੱਚ ਮੈਂ ਨੋਰਮਲੀ ਡੇਲੀ ਬੇਸਿਸ 'ਤੇ ਡੇਲੀ ਰੂਟੀਨ 'ਚ ਫੋਟੋਗ੍ਰਾਫੀ ਕਰਦੀ ਰਹਿੰਦੀ ਹਾਂ ਨੇਚਰ ਦੀ ਅ ਹਾਊਸ ਦੀ ਸ ਆਪਣੇ ਆਪ ਦੀ ਜਿਹੜੀ ਚੀਜ਼ਾਂ ਮੈਨੂੰ ਵਧੀਆ ਲੱਗਦੀਆਂ ਵਧੀਆ ਮਿਲਦੀਆਂ ਉਹਨਾਂ ਦੀ ਮੈਂ ਫੋਟੋਗ੍ਰਾਫੀ ਕਰਦੀ ਹਾਂ ਮੈਂ ਆਪਣੀ ਫੋਟੋਗ੍ਰਾਫੀ ਸਕਿਲਸ ਇਮਪਰੂਵ ਅਲੱਗ ਅਲੱਗ ਤਰੀਕਿਆਂ ਨਾਲ ਕੀਤੀਆਂ ਜਿਵੇਂ ਕਿ ਮੈਂ ਕਾਫ਼ੀ ਪ੍ਰੈਕਟਿਸ ਅਤੇ ਐਕਸਪਰੀਮੈਂਟ ਕਰਦੀ ਹਾਂ ਮੈਂ ਰੈਗੂਲਰ ਬੇਸਿਸ 'ਤੇ ਫੋਟੋਗ੍ਰਾਫੀ ਕਰਦੀ ਹਾਂ ਜਿਵੇਂ ਕਿ ਮੇਰੇ ਹਾਊਸ ਦੇ ਵਿੱਚ ਕਾਫ਼ੀ ਪਲਾਂਟਸ ਨੇ ਤਾਂ ਮੈਂ ਨੇਚਰ ਦੀ ਪਲਾਂਟਸ ਦੀ ਫੋਟੋਗ੍ਰਾਫੀ ਕਰਦੀ ਹਾਂ ਡਿਫਰੈਂਟ ਸਟਾਈਲ ਦੇ ਵਿੱਚ ਡਿਫਰੈਂਟ ਟੈਕਨੀਕਸ ਦੇ ਨਾਲ ਜਿਹਦੇ ਕਰਕੇ ਮੇਂ ਮੈਂ ਆਪਣਾ ਕੈਮਰਾ ਹਮੇਸ਼ਾਂ ਆਪਣੇ ਕੋਲ ਰੱਖਦੀ ਹਾਂ ਅਤੇ ਮੂਵਮੈਂਟਸ ਕੈਪਚਰ ਕਰਦੀ ਹਾਂ ਅਤੇ ਨਿਊ ਪਰਸਪੈਕਟਿਵ ਨਾਲ ਟਰਾਈ ਕਰਦੀ ਹਾਂ ਅਤੇ ਇਹਦੇ ਮੈਂ ਆਪਣੇ ਪੇਰੈਂਟਸ ਦੀ ਆਪਣੇ ਹਸਬੈਂਡ ਦੀ ਆਪਣੇ ਫਰੈਂਡਸ ਦੀ ਆਪਣੀ ਫੈਮਲੀ ਦੀ ਰਾਇ ਲੈਂਦੀ ਹਾਂ ਆ ਵੀ ਮੇਰੇ ਫੋਟੋਗਰਾਫਸ ਕਿੱਦਾਂ ਦੇ ਹਨ ਉਹ ਮੈਨੂੰ ਫਿਰ ਗਾਈਡ ਕਰਦੇ ਆ ਕਿ ਤੁਹਾਡੇ ਆਹ ਫੋਟੋ ਥੋੜ੍ਹੇ ਇਸ ਐਂਗਲ ਵਿੱਚ ਹੋਣੀ ਚਾਹੀਦੀ ਉਸ ਐਂਗਲ ਵਿੱਚ ਹੋਣੀ ਚਾਹੀਦੀ ਆ ਲਾਈਟਿੰਗ ਵੱਧ ਘੱਟ ਚਾਹੀਦੀ ਆ ਨਿਊ ਟੈਕਨੀਕਸ ਦੱਸਦੇ ਆ ਫਿਰ ਉਹ ਹਿਸਾਬ ਨਾਲ ਮੈਂ ਅ ਪ੍ਰੈਕਟਿਸ ਕਰਦੀ ਹਾਂ ਅਤੇ ਆਪਣੇ ਆ ਫੋਟੋਗ੍ਰਾਫੀ ਸਕਿਲ ਨੂੰ ਇੰਪਰੂਵ ਕਰਦੀ ਹਾਂ ਜਿਵੇਂ ਕਿ ਮੈਂ ਲੇਟੈਸਟ ਹੀ ਇੱਕ ਫੋਟੋਗ੍ਰਾਫੀ ਗੂਗਲ ਵਰਕਸ਼ਾਪ ਅਟੈਂਡ ਕੀਤਾ ਸੀ ਜਿਹਦੇ ਵਿੱਚ ਮੈਨੂੰ ਕਾਫ਼ੀ ਟੈਕਨੀਕਸ ਲਰਨ ਕਰਨ ਨੂੰ ਮਿਲੀਆਂ ਲਾਈਟਿੰਗ ਕਿਵੇਂ ਸੈੱਟ ਕਰਨੀ ਕੰਪੋਜੀਸ਼ਨ ਐਡੀਟਿੰਗ ਹੋਰ ਕਾਫ਼ੀ ਐਕਸਪੀਰੀਅੰਸਡ ਜਿਹੜੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਸੀ ਉਹਨਾਂ ਦੇ ਵੇਅ ਆਫ ਦੇਅਰ ਇੰਪਰੂਵਿੰਗ ਹਾਉ ਕਿਵੇਂ ਉਹ ਕਰਦੇ ਆ ਉਹ ਦੇਖਣ ਨੂੰ ਮਿਲਿਆ ਮੈਨੂੰ ਉਹਤੋਂ ਇਲਾਵਾ ਮੈਂ ਹਮੇਸ਼ਾਂ ਟੈਕਨੋਲੋਜੀ ਨਾਲ ਅਪਡੇਟ ਰਹਿੰਦੀ ਹਾਂ ਜਿਹਦੇ ਕਰਕੇ ਮੈਨੂੰ ਬਹੁਤ ਈਜ਼ੀ ਹੁੰਦਾ ਆ ਫੋਟੋਗ੍ਰਾਫੀ ਕਰਨਾ ਐਂਡ ਆਲਸੋ ਮੈਂ ਕਾਫ਼ੀ ਕਲਾਸਿਕ ਫੋਟੋਗ੍ਰਾਫਰਸ ਨੇ ਜਿਵੇਂ ਕਿ ਐਂਸਲ ਐਡਮ ਹੈਗੇ ਆ ਜਿਹੜੇ ਕਿ ਬਹੁਤ ਵਧੀਆ ਲੈਨਡਸਕੇਪ ਫੋਟੋਗ੍ਰਾਫੀ ਕਰਦੇ ਆ ਉਹਨਾਂ ਤੋਂ ਮੈਂ ਬਹੁਤ ਜ਼ਿਆਦਾ ਇੰਸਪਾਇਰ ਹੋਈ ਹਾਂ ਅਤੇ ਬਾਕੀ ਨੇਚਰ ਐਂਡ ਡੇਲੀ ਲਾਈਫ ਕਰਕੇ ਨੈਚੁਰਲ ਵਰਲਡ ਕਰਕੇ ਮੈਂ ਜ਼ਿਆਦਾ ਕੈਂਡਿਡ ਮੂਵਮੈਂਟਸ ਕਲਿੱਕ ਕਰਨੇ ਉਹਦੇ ਨਾਲ ਜ਼ਿਆਦਾ ਇਨਸਪਾਇਰ ਹੋਈ ਹਾਂ ਮੈਂ